ਹੈਲੋ ਵਧੀਆ ਤੁਸੀਂ ਕਿਵੇਂ ਹੋ ਹਾਂ ਵਧੀਆ ਸਬ ਅਤੇ ਤੈਨੂੰ ਪਤਾ ਇਥੇ ਨਯਾ ਕੋਚਿੰਗ ਸੈਂਟਰ ਖੁੱਲ੍ਹਿਆ ਫਿਰ ਕੀ ਕੀ

ਹੁੰ ਹਾਂ ਫਿਰ ਮੈਂ ਵੀ ਤੈਨੂੰ ਇਹੀ ਸਲਾਹ ਦਿੰਦੀ ਸੀ ਕਿ ਡਰੀਮ 'ਚ ਦੇਖ ਲੈ ਹੂੰ ਅੱਛਾ ਤੂੰ ਲਿੱਤੀ ਹੋਈ ਹੈ ਪਹਿਲੇ ਅੱਛਾ ਵੈਸੇ ਮੈਂ ਵੇਖੀ ਹੁੰਦੀ ਆ ਮੈਂ ਤਾਂ ਓਲ ਕੰਪਿਊਟਰ ਇਗ੍ਜ਼ੈਮ ਦੀ ਲੈਣੀ ਆ ਨਾ ਤਾਂ ਤੂੰ ਮੈਨੂੰ ਸਲਾਹ ਦੇ ਦੇ ਕਿੱਥੋਂ ਲਵਾਂ ਅੱਛਾ ਅੱਛਾ ਅਤੇ ਸਟਾਫ ਵਧੀਆ ਹੈ ਕੰਮ ਵਗੈਰਾ ਚੰਗਾ ਹੈ ਚੱਲ ਇਹ ਤਾਂ ਗੱਲ ਠੀਕ ਆ ਆਨਲਾਈਨ ਅਤੇ ਆਫਲਾਈਨ 'ਚ ਚੱਲ ਜਦ ਮਨ ਨਾ ਕਰਿਆ ਤਾਂ ਆਨਲਾਈਨ ਆਪਾਂ ਲੈ ਸਕਦੇ ਹਾਂ ਕਿਸੇ ਵੀ ਮੁਸ਼ਕਲ ਸਮੇਂ ਹੂੰ ਹਾਂ ਰਿਕੋਡਡ ਵੀ ਨੇ ਨਾ ਹਾਂ ਹਾਂ ਠੀਕ ਹੈ ਚਲ ਠੀਕ ਆ ਵਧੀਆ ਬਾਏ